ਹਾਲ ਵਿੱਚ ਹੀ ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ ਹੈ ਜਿਸ ਵਿੱਚ ਹਫ਼ਤਾ ਪਹਿਲਾਂ ਅਸੀਂ ਘਰਾਂ ਦੀ ਸਫ਼ਾਈ ਕੀਤੀ ਔਰ ਘਰਾਂ ਦੇ ਵਿੱਚ ਲੜੀਆਂ ਵਗੈਰਾ ਲਗਾਈਆਂ ਇਸ ਤੋਂ ਇਲਾਵਾ ਰਾਤ ਨੂੰ ਦੀਵੇ ਵਗੈਰਾ ਲਗਾਏ ਔਰ ਮਠਿਆਈਆਂ ਵਗੈਰਾ ਲਿਆਂਦੀਆਂ ਔਰ ਲੱਛਮੀ ਮਾਤਾ ਦੀ ਪੂਜਾ ਕੀਤੀ ਇਸ ਤੋਂ ਇਲਾਵਾ ਰਾਤ ਨੂੰ ਅਸੀਂ ਪਟਾਕੇ ਵਗੈਰਾ ਵੀ ਚਲਾਏ ਔਰ ਰਾਤ ਨੂੰ ਅਸੀਂ ਸੋ ਗਏ ਉਸ ਤੋਂ ਅਗਲੇ ਦਿਨ ਬੜੀ ਦੀਵਾਲੀ ਆਉਂਦੀ ਹੈ ਬੜੀ ਦੀਵਾਲੀ ਨੂੰ ਫਿਰ ਅਸੀਂ ਲੱਛਮੀ ਮਾਤਾ ਦੀ ਪੂਜਾ ਕੀਤੀ ਔਰ ਰਾਤ ਨੂੰ ਦੀਵੇ ਵਗੈਰਾ ਲਗਾਏ ਔਰ ਪਟਾਕੇ ਚਲਾਏ ਔਰ ਅਸੀਂ ਦੀਵਾਲੀ 'ਤੇ ਖੂਬ ਆਨੰਦ ਲਿੱਤਾ